ਪੰਜਾਬ ਭਾਰਤ ਦਾ ਇੱਕ ਸੂਬਾ ਹੈ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਭਾਰਤ ਦੇ ਸੱਭਿਆਚਾਰ ਨਾਲੋਂ ਥੋੜ੍ਹਾ ਜਿਹਾ ਵੱਖਰਾ ਵੀ ਹੈ ਪਰ ਭਾਰਤ ਦੇ ਜ਼ਿਆਦਾਤਰ ਰਾਜਾਂ ਦੇ ਵਿੱਚ ਕਿਉਂਕਿ ਸੱਭਿਆਚਾਰ ਬਹੁਤ ਭਾਂਤ ਭਾਂਤ ਦੇ ਸੱਭਿਆਚਾਰ ਮਿਲਦੇ ਹਨ ਪੰਜਾਬ ਦੇ ਵਿੱਚ ਖਾਸ ਕਰਕੇ ਜੋ ਕਿ ਭੰਗੜਾ ਗਿੱਧਾ ਇ ਇਹਦਾ ਸੱਭਿਆਚਾਰ ਹੈ ਅਲੱਗ ਅਲੱਗ ਜੋ ਕਿ ਪੰਜਾਬ ਲਾ ਪੰਜਾਬ ਦਾ ਖਾਣਾ ਜੋ ਮਸ਼ਹੂਰ ਹੈ ਜਿਵੇਂ ਕਿ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਮੱਖਣੀ ਨਾਲ ਲੱਸੀ ਇਹ ਪੂਰੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਵਿੱਚ ਨਹੀਂ ਪੂਰੇ ਦੁਨੀਆ ਦੇ ਵਿੱਚ ਮਸ਼ਹੂਰ ਹੈ ਲੱਸੀ ਤਾਂ ਬਹੁਤ ਹੀ ਮਸ਼ਹੂਰ ਹੈ ਅਤੇ ਇੱਥੇ ਦੇ ਜੋ ਗਾਣੇ ਹਨ ਪੰਜਾਬੀ ਗਾਣੇ ਹਨ ਉਹ ਪੂਰੇ ਦੁਨੀਆ ਦੇ ਵਿੱਚ ਗਾਏ ਜਾਂਦੇ ਹਨ ਜਿਵੇਂ ਕਿ ਭਾਵੇਂ ਗੋਰੇ ਭਾਵੇਂ ਕਾਲੇ ਭਾਵੇਂ ਭਾਂਤ ਭਾਂਤ ਤਰ੍ਹਾਂ ਦੇ ਲੋਕ ਦੁਨੀਆ ਦੇ ਵਿੱਚ ਵੱਸਦੇ ਹਨ ਉਨਾਂ ਨੂੰ ਚਾਹੇ ਪੰਜਾਬੀ ਸਮਝ ਆਉਂਦੀ ਹੋਵੇ ਚਾਹੇ ਨਾ ਆਉਂਦੀ ਹੋਵੇ ਉਹ ਪੰਜਾਬੀ ਗਾਣਿਆਂ ਦੇ ਉੱਤੇ ਆਪ ਆਪ ਮੁਹਾਰੇ ਹੀ ਭੰਗੜਾ ਪਾਉਣ ਲਾਪ ਲੱਗ ਪੈਂਦੇ ਹਨ